ਹਾਂਜੀ ਸਤਿ ਸ਼੍ਰੀ ਆਕਾਲ ਜੀ ਜੇਕਰ ਗੱਲ ਕਰੀਏ ਅੱਜ ਫਸਲਾਂ ਦੀ ਤਾਂ ਮੱਧਪੁਰਸ਼ ਸਾਡੀ ਬਹੁਤ ਹੀ ਜ਼ਿਆਦਾ ਫਸਲਾਂ ਵਿੱਚ ਵੇਚਣ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦੇ ਹਨ ਇਹਨਾਂ ਦੇ ਨਾਲ ਸਾਨੂੰ ਕੋਈ ਵੀ ਤੰਗੀ ਨਹੀਂ ਆਉਂਦੀ ਅਤੇ ਸਾਡੀ ਜਿਹੜੀ ਫਸਲ ਹੈ ਉਹ ਟੈ 'ਤੇ ਕੱਟ ਕੇ ਟਾਈਮ ਸਿਰ ਗਿਰ ਫਸਲ ਗਿਰ ਜਾਂਦੀ ਹੈ ਅਤੇ ਜਿਹੜੀ ਸਾਨੂੰ ਪੈਸੇ ਹੈ ਉਹ ਵੀ ਛੇਤੀ ਹੀ ਟਾਈਮ ਟੂ ਟਾਈਮ ਮਿਲ ਜਾਂਦੇ ਹਨ ਅਤੇ ਇਸਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੈ